ਹਾਂਜੀ ਹੈਲੋ ਮੈਂ ਆਪਣੀ ਅਤੇ ਆਪਣੀ ਤੁਹਾਡੀ ਮੀਸ਼ੋ ਤੋਂ ਇੱਕ ਸ਼ਰਟ ਮੰਗਵਾਈ ਸੀਗੀ ਜਿਹੜੀ ਮਤਲਬ ਕਿ ਬਹੁਤ ਜ਼ਿਆਦਾ ਵਧੀਆ ਨਿਕਲੀ ਇਕੱਲੀ ਨਾ ਹੀ ਉਹਦਾ ਕੋਈ ਕਲਰ ਨਿਕਲਿਆ ਅਤੇ ਨਾ ਹੀ ਉਹ ਕੋਈ ਸਰਿੰਕ ਬਹੁਤ ਜ਼ਿਆਦਾ ਫੀਟਿੰਗ ਆਈ ਅਤੇ ਮੈਂ ਜਦੋਂ ਪਾਈ ਤਾਂ ਮੈਨੂੰ ਮੇਰੀਆਂ ਫਰੈਂਡਸ ਵਗੈਰਾ ਨੇ ਵੀ ਪੁੱਛਿਆ ਵੀ ਤੁਸੀਂ ਨੇ ਕਿੱਥੋਂ ਬਾਏ ਕੀਤੀ ਹੈਗੀ ਤਾਂ ਫਿਰ ਮੈਨੇ ਉਹਦੇ ਬਾਰੇ ਦੱਸਿਆ ਉਹਨਾਂ ਨੂੰ ਵੀ ਮੈਂ ਬਹੁਤ ਵਾਰ ਮਤਲਬ ਕਿ ਕੋਈ ਸ਼ਰਿੰਕ ਨਹੀਂ ਹੋਈ ਕੋਈ ਵੀ ਤੋਂ ਫਟੀ ਨਹੀਂ ਹੋਈ ਸੀ ਬਹੁਤ ਜ਼ਿਆਦਾ ਕਲਰ ਸੀ ਜਿੱਦਾਂ ਦਾ ਮੈਨੇ ਆਰਡਰ ਕੀਤਾ ਸੀ ਉੱਦਾਂ ਦਾ ਹੀ ਮੈਨੂੰ ਮਿਲਿਆ ਅਤੇ ਮੈਂ ਮਤਲਬ ਕਿ ਅੱਗੇ ਤੋਂ ਚਾਹਵਾਂਗੀ ਕਿ ਉਹ ਉਸੇ ਮੀਸ਼ੋ ਤੋਂ ਹੀ ਮੰਗਵਾਵਾਂ ਜਿਹੜੀਆਂ ਚੀਜ਼ਾਂ ਮਤਲਬ ਕਿ ਵਧੀਆਂ ਮਿਲਦੇ ਨੇ ਪਲਾਸਟਿਕ ਦੀਆਂ ਚੀਜ਼ਾਂ ਵੀ ਮਤਲਬ ਕਿ ਬਹੁ ਜ਼ਿਆਦਾ ਵਧੀਆ ਪਲਾਸਟਿਕ ਦੀ ਚੀਜ਼ ਵੀ ਮੰਗਵਾਈ ਸੀ ਪਲਾਸਟਿਕ ਦੀ ਬਹੁਤ ਜ਼ਿਆਦਾ ਵਧੀਆ ਨਿਕਲੀ ਸੀ ਕਰੋਕਰੀ ਦਾ ਸਮਾਨ ਵੀ ਬਹੁਤ ਜ਼ਿਆਦਾ ਵਧੀਆ ਨਿਕਲਿਆ ਸੀਗਾ ਮੈਨੂੰ ਪੁੱਛਿਆ ਸੀਗਾ ਇੱਕ ਦੋ ਨੇ ਮੈਨੇ ਦੱਸਿਆ ਵੀ ਹਾਂ ਵੀ ਜਦੋਂ ਚੀਜ਼ ਮੰਗਵਾਓ ਅਤੇ ਬਹੁਤ ਜ਼ਿਆਦਾ ਵਧੀਆ ਪ੍ਰੋਟੈਕਟ ਨਹੀਂ ਗੇ ਮੀਸ਼ੋ ਦੇ ਬਹੁਤ ਜ਼ਿਆਦਾ ਵਧੀਆ ਜੀ